ਹੈਲੋ ਸਤਿ ਸ਼੍ਰੀ ਅਕਾਲ ਸਰ ਕੋ ਤੁਹਾਡੀ ਕਾਰ ਜਿਹੜੀ ਸੀ ਅਸੀਂ ਮਤਲਬ ਬੁੱਕ ਕਰਵਾਉਣੀ ਸੀ ਅਤੇ ਅਸੀਂ ਪਿਛਲੀ ਵਾਰ ਵੀ ਤੁਹਾਡੀ ਕਾਰ ਦੀ ਬੁਕਿੰਗ ਕੀਤੀ ਸੀ ਸਾਨੂੰ ਮਤਲਬ ਤੁਹਾਡੀ ਡਰਾਈਵਿੰਗ ਬਹੁਤ ਪਸੰਦ ਆਈ ਸੀ ਕਾਰ ਵੀ ਤੁਹਾਡੀ ਸਾਫ਼ ਸੁਥਰੀ ਸੀ ਅਤੇ ਇਸ ਕਰਕੇ ਅਸੀਂ ਤੁਹਾਨੂੰ ਬੁੱਕ ਚਾਹੁੰਦੇ ਹਾਂ ਅਸੀਂ ਜਲੰਧਰ ਵੰਡਰਲੈਂਡ ਜਾਣਾ ਅੰਮ੍ਰਿਤਸਰ ਤੋਂ ਅਤੇ ਸਾਡੇ ਘਰ ਦੇ ਕੁੱਲ ਮੈਂਬਰ ਸੈਵਨ ਹੈਗੇ ਨੇ ਜੋ ਕਿ ਸਾਡੀ ਪੂਰੀ ਫੈਮਿਲੀ ਜਾ ਰਹੀ ਹੈ ਨਾਲ ਬੱਚੇ ਵੀ ਨੇ ਅਤੇ ਅਸੀਂ ਅੰਮ੍ਰਿਤਸਰ ਤੋਂ ਜਲੰਧਰ ਵੰਡਰਲੈਂਡ ਜਾਣਾ ਚਾਹੁੰਨੇ ਹਾਂ ਅਤੇ ਸਾਡਾ ਮਤਲਬ ਜਿਹੜਾ ਤੁਸੀਂ ਅੱਜ ਸ਼ਾਮੀ ਇੱਕ ਫਰਵਰੀ ਨੂੰ ਸ਼ਾਮੀ ਛੇ ਕੁ ਵਜੇ ਆ ਛੇ ਵਜੇ ਦੇ ਆਗੇ ਲਗਭਗ ਛੇ ਵਜੇ ਦੇ ਲਗਭਗ ਆ ਜਾਓ ਅਤੇ ਅਸੀਂ ਜਿਹੜੇ ਹਾਂ ਗੋਲਡਨ ਟੈਂਪਲ ਦੇ ਕੋਲ ਬਾਬਾ ਸਰ ਚੌਂਕ ਦੇ ਨੇੜੇ ਰਹਿੰਦੇ ਹਾਂ ਅਤੇ ਤੁਸੀਂ ਸਾਨੂੰ ਸ਼ਾਮੀ ਛੇ ਵਜੇ ਤੱਕ ਪਿਕ ਅਪ ਕਰ ਲਓ ਜੋ ਕਿ ਅਸੀਂ ਉੱਥੇ ਟਾਈਮ ਸਿਰ ਉੱਥੇ ਪਹੁੰਚ ਸਕੀਏ ਥੈਂਕ ਯੂ